ਇੱਕ ਵਾਰ ਦੀ ਗੱਲ ਆ ਕਿ ਅਸੀਂ ਚਲੋ ਸਾਰੇ ਜਾਣੇ ਫੈਮਲੀ ਬੈਠੇ ਸੀ ਅਤੇ ਮੇਰੇ ਮੰਮੀ ਦਾ ਜਨਮ ਦਿਨ ਸੀ ਅਸੀਂ ਬਾਹਰ ਜਾਣ ਦੀ ਬਜਾਏ ਸੋਚਿਆ ਕਿ ਚਲੋ ਕੁਛ ਘਰ ਔਡਰ ਕਰ ਲੈਂਦੇ ਹਾਂ ਜਿਸ ਕਰਕੇ ਅਸੀਂ ਬੈਠੇ ਬੈਠਿਆਂ ਗੱਲਾਂ ਬਾਤਾਂ ਵਿੱਚ ਹੀ ਸਲਾਹ ਬਣਾ ਲਈ ਅਤੇ ਔਡਰ ਕਰ ਦਿੱਤਾ ਅਤੇ ਉ ਉਸੇ ਟਾਈਮ ਹੀ ਦਸ ਮਿੰਟ ਬਾਅਦ ਫੋਨ ਆਇਆ ਸਾਡੇ ਚਾਚਾ ਜੀ ਦਾ ਉਹਨਾਂ ਨੇ ਕਿਹਾ ਕਿ ਅਸੀਂ ਆ ਰਹੇ ਹਾਂ ਤੁਹਾਡੇ ਕੋਲ ਆਪਾਂ ਜਾਣਾ ਏ ਅੱਗੇ ਕਿਤੇ ਉਹਨਾਂ ਪਾਰਟੀ ਕਰਨ ਅਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਘਰ ਮੰਗਵਾਇਆ ਹੋਇਆ ਪਰ ਬਹੁਤ ਬਹਿਸ ਤੋਂ ਬਾਅਦ ਉਹ ਕਹਿੰਦੇ ਨਹੀਂ ਤੁਸੀਂ ਘਰ ਨਹੀਂ ਮੰਗਵਾਉਣਾ ਸੀ ਇਹ ਉਹ ਅਤੇ ਅਸੀਂ ਚਲੋ ਫਿਰ ਉਹਨਾਂ ਨਾਲ ਚਲੇ ਗਏ ਬਾਹਰ ਚਲੇ ਗਏ ਅਤੇ ਹੁਣ ਸਾਨੂੰ ਅਸੀਂ ਮੰਗਾਇਆ ਹੋਇਆ ਸੀ ਉਹ ਵੇਸਟ ਵੀ ਨਹੀਂ ਕਰ ਸਕਦੇ ਸੀ ਜਿਸ ਕਰਕੇ ਹੁਣ ਸਾਨੂੰ ਆਪਣਾ ਐਡਰੈਸ ਚੇਂਜ ਕਰਨਾ ਸੀ ਅਤੇ ਅਸੀਂ ਆਪਣੇ ਉਹਨਾਂ ਨੂੰ ਫੋਨ ਕਰਕੇ ਕਿਹਾ ਜਾਂ ਉਹਨਾਂ ਨੂੰ ਮੇਲ ਪਾਈ ਅਤੇ ਉਹਨਾਂ ਤੋਂ ਐਡਰੈੱਸ ਚੇਂਜ ਕਰਾਇਆ ਸਾਨੂੰ ਇਸ ਵਿੱਚ ਕੋਈ ਮੁਸ਼ਕਿਲ ਨਹੀਂ ਆਈ ਹੈਗੀ ਈਜ਼ੀ ਹੋ ਗਿਆ ਸੀ ਬਟ ਥੋੜ੍ਹਾ ਪ੍ਰੋਬਲਮ ਹੋ ਜਾਂਦੀ ਹੈ ਜਦੋਂ